ਹਾਲ ਹੀ 'ਚ ਮੈਂ ਐਮਾਜ਼ੋਨ ਤੋਂ ਆਪਣੀ ਪਹਿਲੀ ਔਨਲਾਈਨ ਸ਼ੋਪਿੰਗ ਕੀਤੀ ਜਿਸ ਵਿੱਚ ਮੈਂ ਆਪਣਾ ਫੁਲੀ ਸਟਿੱਚ ਸੂਟ ਸ ਮੰਗਵਾਇਆ ਉਹ ਇੱਕ ਲਿਬਾਸ ਕਲੈਕਸ਼ਨ ਦਾ ਸੀ ਇਹ ਸੂਟ ਬਹੁਤ ਵਧੀਆ ਕੋਟਨ ਦੇ ਸਟਫ ਵਿੱਚ ਸੀ ਅਤੇ ਇਸ 'ਤੇ ਕੱਪੜਾ ਵੀ ਬਹੁਤ ਫਾਈਨ ਸੀ ਇਹ ਜਿਵੇਂ ਦਾ ਔਨਲਾਈਨ ਦਿਖ ਰਿਹਾ ਸੀ ਉਵੇਂ ਦਾ ਹੀ ਬਹੁਤ ਵਧੀਆ ਪ੍ਰਿੰਟ ਅਤੇ ਫਿਟਿੰਗ ਵਾਲਾ ਸੀ ਇਸਦਾ ਸਾਈਜ਼ ਵੀ ਬਿਲਕੁਲ ਸਹੀ ਸੀ ਅਤੇ ਇਹਦੇ ਵਿੱਚ ਇਹ ਸਕੀਮ ਸੀ ਕਿ ਫਸਟ ਪ੍ਰੋਡਕਟ ਖਰੀਦਣ 'ਤੇ ਮੈਨੂੰ ਦਸ ਪ੍ਰਸੈਂਟ ਡਿਸਕਾਊਂਟ ਵੀ ਉਪਲਬਧ ਸੀ ਇਸ ਦੀ ਫਿਟਿੰਗ ਬਹੁਤ ਸੋਹਣੀ ਆਈ ਹੈ ਅਤੇ ਇਸ ਦੇ ਸ ਕਲਰ ਵੀ ਬਿਲਕੁਲ ਜਿਵੇਂ ਔਨਲਾਈਨ ਦਿਖ ਰਿਹਾ ਸੀ ਉਵੇਂ ਦਾ ਹੀ ਸੀ ਉੱਪਰੋਂ ਇਸ ਸਾਈਟ ਨੇ ਫਸਟ ਪ੍ਰੋਡਕਟ ਖਰੀਦਣ 'ਤੇ ਡਿਸਕਾਊਂਟ ਵੀ ਦਿੱਤਾ ਸੀ ਜਿਸ ਕਰਕੇ ਮੇਰਾ ਇਸ ਸਾਈਟ ਨਾਲ ਬਹੁਤ ਚੰਗਾ ਵਧੀਆ ਐਕਸਪੀਰੀਐਂਸ ਰਿਹਾ ਅਤੇ ਮੈਂ ਆਪਣੇ ਪ੍ਰੋਡਕਟ ਦੇ ਪ੍ਰਤੀ ਬਹੁਤ ਖੁਸ਼ ਹਾਂ